ਅੱਜ ਦੇ ਸਮੇਂ ਵਿੱਚ ਖੁ ਕਿਸਾਨਾਂ ਦੁਆਰਾ ਕੀਤੀ ਗਈ ਖੁਦਕੁਸ਼ੀ ਬਹੁਤ ਹੀ ਜ਼ਿਆਦਾ ਬੜਾ ਮੁੱਦਾ ਹੈ ਅਤੇ ਇਸ ਨੂੰ ਨਜਿੱਠਣ ਲਈ ਕਈ ਸੰਸਥਾਵਾਂ ਜਿਵੇਂ ਕਿ ਕਿਸਾਨ ਯੂਨੀਅਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਉੱਤੇ ਫੋਨ ਕਰਕੇ ਕਿਸਾਨ ਖ ਇਨ੍ਹਾਂ ਖੁਦਕੁਸ਼ੀਆਂ ਤੋਂ ਬਚ ਸਕਦਾ ਹੈ ਮਈ ਕਿਸਾਨੀ ਕਿਸਾਨ ਦੀ ਖੁਦਕੁਸ਼ੀ ਪਰਿਵਾਰ ਲਈ ਬਹੁਤ ਹੀ ਜ਼ਿਆਦਾ ਔਖੀ ਚੀਜ਼ ਹੈ ਕਿ ਉਹ ਬੰਦਾ ਤਾਂ ਇਸ ਦੁਨੀਆ ਵਿੱਚੋਂ ਚਲ ਜਾਂਦਾ ਹੈ ਪਰ ਆਪਣੇ ਪਰਿਵਾਰ ਉੱਤੇ ਬਹੁਤ ਹੀ ਜ਼ਿਆਦਾ ਬੋਝ ਛੱਡ ਜਾਂਦਾ ਹੈ ਉਸ ਦੇ ਬੱਚੇ ਅੱਗੇ ਬਹੁਤ ਹੀ ਜ਼ਿਆਦਾ ਕ ਕਸ਼ਟ ਵਿੱਚ ਰਹਿੰਦੇ ਹਨ ਅਤੇ ਬਹੁਤ ਹੀ ਤੰਗੀਆਂ ਨਾਲ ਨਜਿੱਠਦੇ ਹਨ ਅਤੇ ਇਸ ਇ ਇਸ ਲਈ ਸਾਡੇ ਖੇਤਰ ਵਿੱਚ ਰੋਪੜ ਵਿੱਚ ਵੀ ਅਜਿਹੇ ਕ ਕਈ ਸਥਾਨ ਹਨ ਜਿੱਥੇ ਕਿਸਾਨਾਂ ਦੀ ਨੂੰ ਮਦਦ ਕੀਤੀ ਜਾਂਦੀ ਹੈ ਅਤੇ ਉਨਾਂ ਨੂੰ ਐ ਇਹਨਾਂ ਚੀਜ਼ਾਂ ਤੋਂ ਬ ਬਚਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਹਨ